ਹਾਂਜੀ ਯੋਗਾ ਨੂੰ ਨਾ ਸ਼ੌਂਕ ਵਜੋਂ ਅਪਣਾਉਣ ਦੇ ਲਈ ਮੈਨੂੰ ਜਿਹੜਾ ਕੀ ਹੈ ਮੈਂ ਇਹਨੂੰ ਕਿ ਮੈਂ ਕਿੱਥੋਂ ਪ੍ਰੇਰਿਤ ਹੋਇਆ ਮੈਂ ਤੁਹਾਨੂੰ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈਗਾ ਮੈਨੂੰ ਟੀਵੀ ਦੇ ਉੱਪਰ ਬਾਬਾ ਰਾਮਦੇਵ ਜੀ ਨੂੰ ਦੇਖਦਾ ਹੁੰਦਾ ਸੀਗਾ ਉਹ ਨਾ ਯੋਗਾ ਦਾ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਜਿਵੇਂ ਉਹ ਆਪਦੇ ਸਰੀਰ ਨੂੰ ਲਚਕ ਦਿੰਦੇ ਨੇ ਹੈ ਨਾ ਕਿਵੇਂ ਉਹ ਦੇਖੋ ਸਾਰੀਆਂ ਬਿਮਾਰੀਆਂ ਤੋਂ ਮੁਕਤ ਨੇ ਨਾ ਜਿਵੇਂ ਇੰਨੀ ਉਮਰ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਦੇਖ ਦੇਖ ਨਾ ਟੀਵੀ ਨੂੰ ਦੇਖ ਦੇਖ ਕੇ ਬਾਬਾ ਰਾਮਦੇਵ ਜੀ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਹੋਇਆ ਅਤੇ ਇਹ ਪ੍ਰੇਰਿਤ ਹੋਣ ਦੇ ਨਾ ਮੇਰੇ ਕਈ ਕਾਰਨ ਸਨ ਇੱਕ ਤਾਂ ਮੈਨੂੰ ਇਹ ਸੀਗਾ ਵੀ ਜੇ ਮੈਂ ਯੋਗਾ ਕਰਾਂ ਬਾਬੇ ਵਾਂਗੂ ਤਾਂ ਮੇਰੇ ਸਿਹਤ ਨੂੰ ਨੂੰ ਜਿਹੜਾ ਲਾਭ ਮਿਲੂਗਾ ਠੀਕ ਹੈ ਅਤੇ ਯੋਗਾ ਜਿਹੜੇ ਮੇਰੇ ਸਰੀਰਕ ਅਤੇ ਅਤੇ ਮੇਰੀ ਮਾਨਸਿਕ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਬਾਬਾ ਜੀ ਇਹੀ ਦੱਸਦੇ ਸੀ ਅਤੇ ਇਹ ਜਿਹੜਾ ਮੇਰਾ ਤਨਾਅ ਘੱਟ ਕਰਨਾ ਹੁੰਦਾ ਸੀਗਾ ਅਤੇ ਲਚਕੀਲਾਪਣ ਮੇਰੀ ਬਾਡੀ ਦੇ ਵਿੱਚ ਆਉਂਦਾ ਸੀਗਾ ਤਾਂ ਜਿਹੜਾ ਕਿ ਬਾਬਾ ਜੀ ਨੇ ਇਹ ਗੱਲ ਨੇ ਵੀ ਮੈਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਅਤੇ ਇੱਕ ਜਿਹੜਾ ਸੀਗਾ ਮੈਨੂੰ ਮਾਨਸਿਕ ਸ਼ਾਂਤੀ ਦੇ ਲਈ ਅਤੇ ਜਿਹੜਾ ਯੋਗਾ ਤਾਂ ਇੰਨਾ ਵਧੀਆ ਮੈਨੂੰ ਲੱਗਾ ਇਹਨੂੰ ਬਾਬਾ ਜੀ ਵਾਰ ਵਾਰ ਸਮਝਾਉਂਦੇ ਸੀ ਵੀ ਯੋਗਾ ਕਰਨ ਦੇ ਨਾਲ ਮਨ ਨੂੰ ਆ ਜਿਹੜੀ ਸ਼ਾਂਤੀ ਮਿਲਦੀ ਹੈ ਅਤੇ ਸਾਨੂੰ ਜਿਹੜਾ ਯੋਗਾ ਕਰਨਾ ਚਾਹੀਦਾ ਹੈ ਅਤੇ ਆਤਮ ਜਾਗਰੂਕਤਾ ਵੀ ਮੇਰੀ ਇਹ ਜਿਹੜੀ ਕੀ ਹੈ ਯੋਗਾ ਕਰਨ ਦੇ ਨਾਲ ਹੀ ਮੈਨੂੰ ਮਿਲੀ ਜਿਹੜਾ ਕਿ ਮੈਨੂੰ ਆਪਣੇ ਸਰੀਰ ਨੂੰ ਮਨ ਦੇ ਨਾਲ ਜੋੜਨ ਅਤੇ ਆਪਣੇ ਆਪ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਦੇ ਨਾਲ ਹੈ ਜਿਹੜੀ ਯੋਗਾ ਦੀ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਆ ਅਤੇ ਜਿਹੜਾ ਮੈਂ ਬਾਬਾ ਰਾਮਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹਨਾਂ ਦੀ ਪ੍ਰੇਰਨਾ ਸਦਕਾ ਮੈਂ ਯੋਗਾ ਨੂੰ ਅਪਣਾਇਆ ਅਤੇ ਆਪਣੇ ਸਰੀਰ ਨੂੰ ਬਹੁਤ ਵਧੀਆ ਤੰਦਰੁਸਤ ਬਣਾਇਆ ਅਤੇ ਚਿੰਤਾ ਮੁਕਤ ਅਤੇ ਐਨ ਲਚਕੀਲਾ ਪੂਰਾ ਵਧੀਆ ਸਰੀਰ ਹੈਗਾ ਹਲਕਾ ਫੁਲਕਾ ਸਰੀਰ ਰਹਿੰਦਾ ਮੇਰਾ ਅਤੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ